ਮੈਂ ਅੱਜ ਪ੍ਰਾਇਮਰੀ ਹੈਲਥ ਸਰਵਿਸਿਜ਼ ਦੀ ਜਾਣਕਾਰੀ ਇੱਥੇ ਦੇਣਾ ਚਾਹਵਾਂਗੀ ਇੱਥੇ ਇਹ ਜਿਹੜੀ ਆ ਇਹ ਪੰਜਾਬ ਵਿੱਚ ਅਪਰੋਕਸ ਨਾਈਨਟੀਨ ਨਾਈਂਟੀ ਫਾਈਵ ਵਿੱਚ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀ ਪਹਿਲਾਂ ਇਹਦਾ ਸੈਂਟਰ ਜਿਹੜਾ ਸੀਗਾ ਉਹ ਖਰੜ ਵਿੱਚ ਸੀ ਉਹ ਕਾਫੀ ਜ਼ਿਆਦੀਆਂ ਮਤਲਬ ਸਹੂਲਤਾਂ ਦੇ ਰਹੇ ਨੇ ਉਹ ਔਰਤਾਂ ਦੇ ਵਾਸਤੇ ਉਹਨਾਂ ਦੇ ਫਰੀ ਇਲਾਜ ਹੁੰਦੇ ਨੇ ਮੈਡੀਕਲ ਚੈੱਕਅਪ ਕੀਤੇ ਜਾਂਦੇ ਨੇ ਰੂਰਲ ਏਰੀਆਜ ਦੇ ਵਿੱਚ ਜਾ ਜਾ ਕੇ ਉਹ ਇਹਨਾਂ ਦੇ ਚੈੱਕਅਪ ਕਰਦੇ ਨੇ ਇਸ ਟਾਈਮ ਕਰੰਟਲੀ ਜਿਹੜੇ ਪ੍ਰਾਈਮਰੀ ਹੈਲਥ ਸਰਵਿਸਿਸ ਵਾਲੇ ਨੇ ਉਹਨਾਂ ਦੀਆਂ ਉੱਨੀ ਡਿਸਟ੍ਰਿਕਟ ਹੋਸਪਿਟਲ ਉੱਨੀ ਡਿਸਟ੍ਰਿਕਟ 'ਚ ਹੋਸਪਿਟਲ ਨੇ ਅਤੇ ਦੋ ਸਪੈਸ਼ਲ ਬ੍ਰਾਂਚਿਸ ਹੈਗੀਆਂ ਨੇ ਜਿੱਥੇ ਆਈਸ ਵਾਸਤੇ ਮਤਲਬ ਬਲਾਇੰਡ ਲੋਕਾਂ ਵਾਸਤੇ ਅਤੇ ਨਾਲੇ ਜਿਨ੍ਹਾਂ ਨੂੰ ਹੇਅਰਿੰਗ ਦੀ ਪ੍ਰੋਬਲਮ ਹੈਗੀ ਆ ਉਹਦੇ ਵਾਸਤੇ ਜਿਹੜੇ ਨੇ ਉਹ ਕਾਫੀ ਸਰਵਿਸਿਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਰਹੇ ਨੇ ਇੱ ਕਾਫੀ ਵੱਡੇ ਲੈਵਲ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਉਹ ਇਹ ਚੀਜ਼ਾਂ ਸ਼ੁਰੂ ਕੀਤੀਆਂ ਇਹ ਉਹਦੇ ਵਿੱਚ ਅਪਰੋਕਸ ਦੋ ਸੌ ਚੌਦਾਂ ਹੈਲਥ ਇੰਸਟੀਟਿਊਟਸ ਆਪਣੀਆਂ ਉਹਨਾਂ ਨੇ ਮਤਲਬ ਹਰ ਟੋਟਲ ਪੰਜਾਬ ਵਿੱਚ ਜਿਹੜੀਆਂ ਉਹ ਖੋਲ੍ਹੀਆਂ ਨੇ ਹਰ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਆ ਉਹ ਅਪਰੋਕਸ ਮਿਲ ਜਾਵੇਗੀ ਕਿ ਤੁਸੀਂ ਇੱਕ ਏਰੀਏ ਦੇ ਵਿੱਚ ਇੱਕ ਡਿਸਟ੍ਰਿਕਟ ਇੱਕ ਡਿਸਟ੍ਰਿਕਟ ਦੇ ਵਿੱਚ ਤੁਸੀਂ ਅਪਰੋਕਸ ਪੰਜ ਤੋਂ ਸੱਤ ਹੋਸਪਿਟਲਸ ਇਹਨਾਂ ਦੇ ਦੇਖ ਸਕਦੇ ਹੋ ਜਿਹੜੇ ਬਜ਼ੁਰਗਾਂ ਨੂੰ ਜਿਹੜੇ ਉਹ ਫਰੀ ਮੈਡੀਕਲ ਚੈੱਕਅਪ ਪ੍ਰੋਵਾਈਡ ਕਰਦੇ ਨੇ ਬੱਚਿਆਂ ਲਈ ਜਿਹੜੀਆਂ ਉਹ ਫਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪੋਲੀਓ ਦੇ ਕੈਂਪਸ ਲਗਾਏ ਜਾਂਦੇ ਨੇ ਉਹਨਾਂ ਦਾ ਹਰ ਤੀਸਰੇ ਮਹੀਨੇ ਫਰੀ ਮੈਡੀਕਲ ਚੈੱਕਅਪ ਕੀਤਾ ਜਾਂਦਾ ਵੈ ਈਵਨ ਔਰਤਾਂ ਨੂੰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਫਰੀ ਔਫ ਕੋਸਟ ਜਿਹੜੇ ਨੇ ਉਹਨਾਂ ਦੇ ਰੈਗੂਲਰ ਜਿਹੜੇ ਪੈਡਸ ਵਗੈਰਾ ਨੇ ਉਹ ਵੀ ਉਹਨਾਂ ਨੂੰ ਪ੍ਰੋ ਸੈਨਟਰੀ ਪੈਡਸ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਜਾਂਦੇ ਨੇ ਵਿਲੇਜ ਏਰੀਅਸ ਵਿੱਚ ਉਹ ਜਾਂਦੇ ਨੇ ਉਹ ਆਪ ਉਹਨਾਂ ਨੂੰ ਸੈਨਟਰੀ ਪੈਡਸ ਜਿਹੜੇ ਨੇ ਉਹ ਦੇ ਕੇ ਆਉਂਦੇ ਨੇ ਇਸ ਤਰ੍ਹਾਂ ਨਾਲ ਕਾਫੀ ਹੱਦ ਤੱਕ ਜਿਹੜੀਆਂ ਇਹਨਾਂ ਨੇ ਮਤਲਬ ਔਰਤਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਉਹ ਜ਼ਰੂਰਤਾਂ ਦਿਤ ਉਹਨਾਂ ਦੀਆਂ ਪੂਰੀਆਂ ਕੀਤੀਆਂ ਨੇ ਈਵਨ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਦੇ ਜੇ ਨੁਕਸ ਵੱਡੇ ਓਪਰੇਸ਼ਨ ਹੁੰਦੇ ਨੇ ਉਹਨਾਂ ਦੇ ਪੈਸੇ ਵੀ ਜਿਹੜੇ ਨੇ ਉਹ ਬਹੁਤ ਘੱਟ ਕਰ ਦਿੱਤੇ ਜਾਂਦੇ ਹਨ